ਅਸੀਂ ਇੱਕੀਵੀਂ ਸਦੀ 'ਚ ਰਹਿ ਰਹੇ ਹਾਂ ਇੱਥੇ ਔਰਤਾਂ ਨੂੰ ਪੂਰਾ ਸਨਮਾਨ ਦਿੱਤਾ ਜਾਂਦਾ ਹੈ ਪਹਿਲੀ ਗੱਲ ਇਹ ਹੈ ਕਿ ਮਨੁੱਖੀ ਸੋਚ ਜੋ ਕਿ ਮਨੁੱਖ ਨੂੰ ਚੰਗਾ ਜਾਂ ਮਾੜਾ ਬਤੀਤ ਕਰਦੀ ਹੈ ਜੇਕਰ ਗੱਲ ਕਰੀਏ ਕੁੜੀਆਂ ਅੱਜ ਵਿੱਚ ਅੱਜ ਹਰ ਇੱਕ ਖੇਤਰ 'ਚ ਅੱਗੇ ਹਨ ਜਿਵੇਂ ਕਿ ਸਰਕਾਰੀ ਨੌਕਰੀ ਏਅਰ ਫੋਰਸ ਪਾਇਲਟ ਡਾਂਸਿੰਗ ਅਤੇ ਹੋਰ ਵੀ ਸਾਰੀਆਂ ਬਹੁਤ ਸਾਰੇ ਕੰਮਕਾਰਾਂ ਵਿੱਚ ਜਿਹੜੇ ਲੋਕ ਸ਼ਹਿਰਾਂ ਵਿੱਚ ਰਹਿੰਦੇ ਹਨ ਉਹ ਇਹਨਾਂ ਸਭ ਚੀਜ਼ਾਂ ਨੂੰ ਨਹੀਂ ਸੋਚਦੇ ਪਰ ਜਿਹੜੇ ਲੋਕ ਪਿੰਡਾਂ 'ਚ ਰਹਿੰਦੇ ਹਨ ਉਹ ਅਜਿਹੀ ਸੋਚ ਦੇ ਮਾਲਕ ਹੁੰਦੇ ਹਨ ਉਹ ਕੁੜੀਆਂ ਨੂੰ ਅਤੇ ਔਰਤਾਂ ਨੂੰ ਵੀ ਘਰ ਤੋਂ ਬਾਹਰ ਜਾਣ ਲਈ ਜ਼ਿਆਦਾ ਪਸੰਦ ਨਹੀਂ ਕਰਦੇ ਹਨ ਉਹ ਔਰਤਾਂ ਅਤੇ ਕੁੜੀਆਂ ਨੂੰ ਘਰ ਤੋਂ ਬਹੁਤਾ ਬਾਹਰ ਵੀ ਜਾਣ ਨਹੀਂ ਦਿੰਦੇ ਹਨ ਜਿਸ ਕਰਕੇ ਕਈ ਔਰਤਾਂ ਆਪਣੇ ਸ਼ੌਂਕ ਮਾਰ ਲੈਂਦੀਆਂ ਹਨ ਜਿਸ ਕਰਕੇ ਉਹਨਾਂ ਦੇ ਸ਼ੌਂਕ ਪੂਰੇ ਨਹੀਂ ਹੁੰਦੇ ਹਨ ਕਈ ਵਾਰ ਤਾਂ ਉਹਨਾਂ ਨੂੰ ਲੋਕਾਂ ਦੇ ਤਾਨੇ ਵੀ ਬਹੁਤ ਸੁਣਨੇ ਪੈਂਦੇ ਹਨ ਕਿ ਜੇਕਰ ਉਹ ਇਹ ਕੰਮ ਕਰਨਗੀਆਂ ਤਾਂ ਉਹਨਾਂ ਨੂੰ ਲੋਕ ਕੀ ਕਹਿਣਗੇ ਅਤੇ ਜਾਂ ਉਹਨਾਂ ਬਾਰੇ ਕੀ ਸੋਚਣਗੇ ਉਹਨਾਂ ਨੂੰ ਇਹ ਵੀ ਸੋਚਣਾ ਪੈਂਦਾ ਹੈ ਕਿ ਰਿਸ਼ਤੇਦਾਰ ਵੀ ਕੀ ਸੋਚਣਗੇ ਕਈ ਰਿਸ਼ਤੇਦਾਰ ਵੀ ਤਾਨੇ ਮਾਰਦੇ ਹਨ ਅਤੇ ਜੋ ਕਿ ਉਹਨਾਂ ਲਈ ਬਹੁਤ ਹੀ ਔਖਾ ਹੈ ਅਤੇ ਇਸ ਲਈ ਹੀ ਕਈ ਕੁੜੀਆਂ ਆਪਣੇ ਬਹੁਤ ਸਾਰੇ ਸ਼ੌਂਕ ਖਤਮ ਕਰ ਲੈਂਦੀਆਂ ਹਨ ਅਤੇ ਕਈ ਕੁੜੀਆਂ ਜਿਹੜੀਆਂ ਡਾਂਸ ਵਗੈਰਾ ਕਰਦੀਆਂ ਹਨ ਉਹ ਦੇ ਘਰ ਦੇ ਵੀ ਜੇਕਰ ਨਾ ਮੰਨਦੇ ਹੋਣ ਤਾਂ ਉਹ ਵੀ ਆਪਣਾ ਸ਼ੌਂਕ ਮਾਰ ਲੈਂਦੀਆਂ ਹਨ ਅਤੇ ਆਰਾਮ ਨਾਲ ਘਰ ਰਹਿੰਦੀਆਂ ਹਨ